ਪੰਜਾਬ ਵਿੱਚ ਕਣਕ ਦੀ ਕਾਸ਼ਤ ਬਹੁਤ ਵਧੀਆ ਹੁੰਦੀ ਹੈ ਬਹੁਤ ਚੰਗੀ ਕਣਕ ਹੁੰਦੀ ਹੈ ਅਤੇ ਕਣਕ ਦੀ ਵਾਢੀ ਤੇਰ੍ਹਾਂ ਅਪ੍ਰੈਲ ਨੂੰ ਕੀਤੀ ਜਾਂਦੀ ਹੈ ਇਸ ਦਿਨ ਪੰਜਾਬ ਦੇ ਲੋਕ ਬਹੁਤ ਖੁਸ਼ੀਆਂ ਮਨਾਉਂਦੇ ਨੇ ਅਤੇ ਕਣਕ ਵਾਸਤੇ ਰੱਬ ਅੱਗੇ ਦੁਆਵਾਂ ਵੀ ਕਰਦੇ ਨੇ ਕਣਕ ਵਧੀਆ ਹੋਵੇ ਅਤੇ ਇੱਥੋਂ ਕਣਕ ਖੇਤਾਂ 'ਚੋਂ ਲਿਜਾ ਕੇ ਵਧੀਆ ਵੱਢ ਕੇ ਉਹਨਾਂ ਨੂੰ ਸਾਫ਼ ਸੁਥਰਾ ਗੋਦਾਮਾਂ 'ਚ ਭਰਿਆ ਜਾਂਦਾ ਉਹ ਤੋਂ ਬਾਅਦ ਇਹ ਮੰਡੀ ਵਿੱਚ ਜਾਂਦੀ ਹੈ ਫਿਰ ਮੰਡੀਆਂ ਵਿੱਚੋਂ ਦੂਰ ਦੂਰ ਤੱਕ ਦੇਸ਼ਾਂ ਵਿਦੇਸ਼ਾਂ 'ਚ ਜਾਂਦੀ ਹੈ ਫਿਰ ਬਾਜ਼ਾਰਾਂ ਵਿੱਚ ਵਿਕਦੀ ਹੈ ਫਿਰ ਘਰਾਂ ਵਿੱਚ ਆਉਂਦੀ ਹੈ